ਅੱਜ ਕੱਲ੍ਹ ਸੰਸਾਰ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਦਾ ਕਾਰਨ ਇਹ ਹੈ ਕਿ ਜਦੋਂ ਅੱਜ ਦੇ ਲੋਕ ਵਿਦੇਸ਼ਾਂ ਵਿੱਚ ਜਾਂਦੇ ਨੇ ਉੱਥੇ ਪੰਜਾਬੀ ਬੋਲਦੇ ਨੇ ਪੰਜਾਬੀ ਬੋਲਣ ਵਾਲਿਆਂ ਨੂੰ ਕੋਈ ਬਹੁਤੀ ਚੰਗੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ ਕਿਉਂਕਿ ਲੋਕਾਂ ਦਾ ਰੁਝਾਨ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ ਵੱਲ ਹੈ ਅੰਗਰੇਜ਼ੀ ਭਾਸ਼ਾ ਬੋਲਣ ਵਾਲਿਆਂ ਨੂੰ ਸਮਝਿਆ ਜਾਂਦਾ ਹੈ ਕਿ ਉਹ ਉੱਚ ਦਰਜੇ ਦਾ ਬੰਦਾ ਹੈ ਇਹ ਪੜ੍ਹਿਆ ਲਿਖਿਆ ਬੰਦਾ ਹੈ ਜਿਹੜਾ ਬੰਦਾ ਆਪਣੀ ਭਈ ਭਾਸ਼ਾ ਨੂੰ ਬੋਲਦਾ ਪੰਜਾਬੀ ਭਾਸ਼ਾ ਨੂੰ ਬੋਲਦਾ ਤੇ ਉਸ ਨੂੰ ਸਮਝਿਆ ਜਾਂਦਾ ਹੈ ਕਿ ਇਹ ਕਿਹੜੀ ਭਾਸ਼ਾ ਅਨਪੜ੍ਹਾਂ ਵਾਲੀ ਭਾਸ਼ਾ ਬੋਲ ਰਿਹਾ ਹੈ ਇਸ ਕਰਕੇ ਇੱਕ ਜਿਹੜਾ ਪੰਜਾਬੀ ਭਾਸ਼ਾ ਬੋਲਣ ਵਾਲਾ ਬੰਦਾ ਹੁੰਦਾ ਹੈ ਉਸ ਨੂੰ ਬਹੁਤ ਨੀਵੀਂ ਨਜ਼ਰ ਨਾਲ ਦੇਖਿਆ ਜਾਂਦਾ ਇਸ ਕਰਕੇ ਲੋਕੀ ਫਿਰ ਕੋਸ਼ਿਸ਼ ਵੀ ਕਰਦੇ ਨੇ ਲੋਕੀ ਅੱਜ ਕੱਲ੍ਹ ਆਪਣੇ ਆਪ ਨੂੰ ਇੱਕ ਸਟੇਟਸ ਸਿੰਬਲ ਬਣਾ ਲਿਆ ਕਿ ਜਿਹੜਾ ਅੰਗਰੇਜ਼ੀ 'ਚ ਗੱਲ ਕਰੇ ਉਹ ਵਧੀਆ ਮੰਨਿਆ ਜਾਣਾ ਹੈ ਲੋਕੀ ਵਿਦੇਸ਼ਾਂ 'ਚ ਜਾਂਦੇ ਨੇ ਜਦੋਂ ਆਇਲਸ ਕਰਕੇ ਜਾਂਦੇ ਨੇ ਅੰਗਰੇਜ਼ੀ ਦਾ ਥੋੜ੍ਹਾ ਗਿਆਨ ਵੀ ਹੈ ਬੱਚਾ ਜਨਮ ਹੀ ਲੈਂਦਾ ਤਾਂ ਉਸ ਨੂੰ ਅੰਗਰੇਜ਼ੀ ਮਤਲਬ ਪੱਖਾ ਵੀ ਕਹਿਣਾ ਹੈ ਤੇ ਉਸ ਨੂੰ ਫੈਨ ਕਿਹਾ ਜਾਂਦਾ ਹੈ ਹਰ ਚੀਜ਼ ਉਸ ਨੂੰ ਹਰ ਸ਼ਬਦ ਅੰਗਰੇਜ਼ੀ ਦੇ ਵਿੱਚ ਸਿਖਾਇਆ ਜਾਂਦਾ ਅਤੇ ਬੱਚੇ ਪੇਰੈਂਟਸ ਵੀ ਕਹਿੰਦੇ ਨੇ ਕਿ ਜਿਹੜੇ ਬੱਚੇ ਨੇ ਉਹ ਅੰਗਰੇਜ਼ੀ ਹੀ ਬੋਲਣ ਤਾਂ ਹੀ ਵਧੀਆ ਲੱਗਣਗੇ ਤਾਂ ਹੀ ਸਾਡੀ ਸਮਾਜ ਦੇ ਵਿੱਚ ਇੱਜ਼ਤ ਬਣੇਗੀ ਇਹ ਜ਼ਿਆਦਾਤਰ ਮਜੋਰਟੀ ਲੋਕ ਜਿਹੜੇ ਨੇ ਉਹ ਅੰਗਰੇਜ਼ੀ ਬੋਲਣ ਵਾਲਿਆਂ ਦੇ ਹੋ ਗਏ ਅਤੇ ਜਿਹੜੇ ਘੱਟ ਬੋਲਣ ਵਾਲੇ ਹੁੰਦੇ ਨੇ ਉਹ ਪੰਜਾਬੀ ਹੁੰਦੇ ਨੇ ਇਸ ਕਰਕੇ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਨੂੰ ਆਪਣੇ ਭਾਸ਼ਾ ਬੋਲਣ ਵਾਲੇ ਜ਼ਿਆਦਾ ਲੋਕ ਨਹੀਂ ਮਿਲਦੇ ਇਹੋ ਜਿਹੀਆਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈ ਰਿਹਾ ਹੈ